ਵੈਸੇ ਤਾਂ ਜੇ ਕੁਦਰਤ ਨੂੰ ਬਿਨਾਂ ਕਿਸੇ ਸੰਪਾਦਿਤ ਕੀਤੇ ਹੋਏ ਹੀ ਦੇਖਿਆ ਜਾਵੇ ਤਾਂ ਉਹ ਬਹੁਤ ਖੂਬਸੂਰਤ ਹੈ ਉਸਨੂੰ ਕਿਸੇ ਵੀ ਸੋ ਸੋਫਟਵੇਅਰ ਦੀ ਲੋੜ ਨਹੀਂ ਹੈ ਉਸਨੂੰ ਹੋਰ ਖੂਬਸੂਰਤ ਬਣਾਉਣ ਦੀ ਪਰ ਜ ਮੈਂ ਕਈ ਵਾਰ ਜੇ ਆਪਣੀ ਕੋਈ ਫੋਟੋ ਤਸਵੀਰ ਸੰਪਾਦਿਤ ਕਰਨੀ ਹੋਵੇ ਤਾਂ ਮੈਂ ਕੋਈ ਸੋਫਟਵੇਅਰ ਨਹੀਂ ਵਰਤਦਾ ਸਿੰਪਲ ਆਪਣਾ ਜਿਹੜਾ ਆਈਫੋਨ ਦੇ ਵਿੱਚ ਹੀ ਫੋਟੋ ਐਡੀਟਿੰਗ ਹੁੰਦੀ ਹੈ ਮੈਂ ਸਿਰਫ਼ ਉਸ ਵਿੱਚ ਹੀ ਉਹ ਐਡਿਟ ਕਰਦਾ ਹਾਂ ਅਤੇ ਸੰਪਾਦਿਤ ਕਰਦਾ ਹਾਂ ਅਤੇ ਮੈਨੂੰ ਲੱਗਦਾ ਉਹ ਕਾਫ਼ੀ ਹੈ ਅਤੇ ਵੈਸੇ ਤਾਂ ਆਪਾਂ ਨੂੰ ਕੋਈ ਵੀ ਜ਼ਰੂਰਤ ਨਹੀਂ ਹੈਗੀ ਕੁਦਰਤ ਦੀ ਖੂਬਸੂਰਤੀ ਨਾਲ ਛੇੜ ਛਾੜ ਕਰਨ ਦੀ ਤੇ ਬਸ ਅ ਅਸੀਂ ਬਸ ਕੁਦਰਤ ਨੂੰ ਮਾਣੀਏ ਅਤੇ ਉਹਦੇ ਅਸਲੀ ਰੰਗ ਨਾਲ ਹੀ ਜੇ ਮੈਂ ਚਾਹਵਾਂ ਤਾਂ ਮੈਂ ਉਹਦੇ ਅਸਲੀ ਰੰਗ ਨਾਲ ਹੀ ਲੋਕਾਂ ਨੂੰ ਰੂਬਰੂ ਕਰਾਵਾਂ